ਅੱਜ ਕੱਲ੍ਹ ਦੇ ਸਮੇਂ ਵਿੱਚ ਪੈਸਾ ਬਹੁਤ ਜ਼ਰੂਰੀ ਬਣ ਗਿਆ ਹੈ ਜਿੱਥੇ ਪੈਸਾ ਕਮਾਉਣਾ ਜ਼ਰੂਰੀ ਬਣ ਗਿਆ ਹੈ ਉੱਥੇ ਹੀ ਪੈਸਾ ਬਚਾਉਣਾ ਵੀ ਓਨਾ ਹੀ ਜ਼ਰੂਰੀ ਬਣ ਗਿਆ ਹੈ ਸਾਨੂੰ ਪੈਸਾ ਬਚਾਉਣਾ ਚਾਹੀਦਾ ਹੈ ਕਿਉਂਕਿ ਬਚਿਆ ਹੋਇਆ ਪੈਸਾ ਸਾਡੇ ਔਖੇ ਸਮੇਂ ਵਿੱਚ ਕੰਮ ਆਉਂਦਾ ਹੈ ਮੈਂ ਕੁਝ ਪੈਸੇ ਖਰਚਣ ਲਈ ਅਲੱਗ ਰੱਖ ਦਿੰਦੀ ਹਾਂ ਅਤੇ ਜੋ ਮੈਂ ਬਚਾਉਣੇ ਹੁੰਦੇ ਹਨ ਉਹ ਮੈਂ ਅਲੱਗ ਰੱਖ ਦਿੰਦੀ ਹਾਂ ਫਿਰ ਮੈਂ ਜੋ ਪੈਸੇ ਬਚਾਉਣੇ ਹੁੰਦੇ ਹਨ ਉਹ ਮੈਂ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੀ ਹਾਂ ਕਿਉਂਕਿ ਬੈਂਕ ਵਿੱਚ ਆਪਣੇ ਪੈਸੇ ਸੇਫ ਹੁੰਦੇ ਹਨ ਅਤੇ ਮੈਂ ਪੈਸੇ ਬੈਂਕ ਵਿੱਚ ਇੱਦਾਂ ਹੀ ਜਮ੍ਹਾਂ ਕਰਵਾ ਕੇ ਰੱਖਣ ਨਾਲੋਂ ਐੱਫ ਡੀ ਕਰਵਾ ਦਿੰਦੀ ਹਾਂ ਕਿਉਂਕਿ ਬੈਂਕ ਵਿੱਚ ਜਮ੍ਹਾਂ ਕਰਵਾਏ ਪੈਸਿਆਂ ਉੱਤੇ ਓਨਾ ਲਾਭ ਨਹੀਂ ਹੁੰਦਾ ਜਿੰਨਾ ਸਾਨੂੰ ਐੱਫ ਡੀ ਕਰਵਾ ਕੇ ਹੁੰਦਾ ਹੈ ਇਸ ਕਰਕੇ ਸਾਨੂੰ ਐੱਫ ਡੀ ਕਰਵਾ ਦੇਣੀ ਚਾਹੀਦੀ ਹੈ